ਭੰਗੜਾ ਪੰਜਾਬ ਦਾ ਰਵਾਇਤੀ ਨਾਚ ਹੈ ਇਹ ਪੰਜਾਬੀ ਕੌਮ ਦਾ ਮੂਲ ਨਿਵਾਸੀ ਹੈ ਬਹੁਤ ਸਮਾਂ ਪਹਿਲਾਂ ਪੰਜਾਬੀ ਕਿਸਾਨਾਂ ਨੇ ਅਨਾਜ ਉਗਾਉਣ ਵਾਕ ਦੀ ਕਰਨ ਅਤੇ ਜ਼ਮੀਨ ਨਾਲ ਸੰਬੰਧਾਂ ਦਾ ਜਸ਼ਨ ਮਨਾਉਣ ਲਈ ਇੱਕ ਨਾਚ ਰੂਪ ਬਣਾਉਣ ਲਈ ਵੱਖ ਵੱਖ ਖੇਤੀਬਾੜੀ ਗਤੀਵਿਧੀਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ ਜਿਸ ਨੂੰ ਬਾਅਦ ਵਿੱਚ ਉਹਨਾਂ ਨੇ ਭੰਗੜਾ ਕਹਿਣਾ ਸ਼ੁਰੂ ਕਰ ਦਿੱਤਾ ਬਹੁਤ ਸਾਰੇ ਲੋਕ ਹਾਸੇ ਮਜ਼ਾਕ ਵਿੱਚ ਭੰਗੜਾ ਪਾਉਂਦੇ ਹਨ ਅਤੇ ਹੱਥਾਂ ਦੇ ਇਸ਼ਾਰਿਆਂ ਨੂੰ

ਦੀ ਕੋਸ਼ਿਸ਼ ਕਰਦੇ ਹਨ ਪਰ ਇਹ ਇਸ ਤੋਂ ਕਿਤੇ ਵੱਧ ਹੈ ਭੰਗੜਾ ਅਸਲ ਵਿੱਚ ਪੰਜਾਬੀ ਕਿਸਾਨਾਂ ਦਾ ਨਾਚ ਹੈ ਵਿਸਾਖੀ ਦੇ ਮੌਸਮ ਜਾਂ ਖਾਲਸਾ ਦਿਵਸ ਦੌਰਾਨ ਆਪਣੀ ਕਣਕ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਲੋਕ ਭੰਗੜਾ ਨੱਚਦੇ ਸੱਭਿਆਚਾਰਕ ਤਿਉਹਾਰਾਂ ਵਿੱਚ ਸ਼ਾਮਿਲ ਹੁੰਦੇ ਹਨ ਭੰਗੜੇ ਨਾਲ ਖੇਤਰ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਸਟੈੱਪ ਸ਼ਾਮਿਲ ਕੀਤੇ ਹਨ ਜਿਸ ਵਿਚ ਲੁੱਡੀ ਝੂਮਰ ਅਤੇ ਹੋਰ ਵੀ ਕਈ ਨਾਚ ਸ਼ਾਮਿਲ ਹਨ ਭੰਗੜੇ ਵਿੱਚ ਸੱਭਿਆਚਾਰ ਨੂੰ ਹੋਰ ਯੋਗਦਾਨ ਪਾਉਣ ਲਈ ਇਸ ਵਿੱਚ ਢੋਲ ਦਾ ਵੀ ਪ੍ਰਯੋਗ ਕੀਤਾ ਜਾਂਦਾ ਹੈ ਢੋਲ ਭੰਗੜੇ ਦੇ ਸਾਜਾਂ ਦਾ ਰਾਜਾ ਹੈ ਹਾਲਾਂਕਿ ਇਸ ਹੋਰ ਵੀ ਬਹੁਤ ਸਾਰੇ ਸੰਗੀਤਕ ਸਾਜ਼ ਸ਼ਾਮਿਲ ਹਨ ਪਰ ਢੋਲ ਹਮੇਸ਼ਾਂ ਭੰਗੜੇ ਦੇ ਨਾਚ ਪਿੱਛੇ ਰਹਿੰਦਾ ਹੈ ਢੋਲ ਨੂੰ ਭੰਗੜੇ ਤੋਂ ਵੱਖ ਕਰਨਾ ਲਗਭਗ ਅਸੰਭਵ ਹੈ ਢੋਲ ਦੇ ਡਗੇ 'ਤੇ ਹੀ ਭੰਗੜਾ ਪਾਇਆ ਜਾਂਦਾ ਹੈ

ਪਰ ਆਮ ਤੌਰ 'ਤੇ ਭੰਗੜਾ ਵਿਆਹ ਸ਼ਾਦੀਆਂ ਵਿੱਚ ਝੂਮਰ ਅਤੇ ਲੂਡੀ ਪਾ ਕੇ ਹੀ ਪਾਇਆ ਜਾਂਦਾ ਹੈ ਭੰਗੜੇ ਦੀਆਂ ਹੋਰ ਵੀ ਕਿਸਮਾਂ ਹਨ ਗਿੱਧਾ ਧਮਾਲ ਸੰਮੀ ਅਤੇ ਆਦਿ ਝੂਮਰ ਜਿਸ ਵਿੱਚ ਇੱਕ ਡਰਮ ਪਲੇਅਰ ਬ ਗਾਣਾ ਗਾਉਂਦਾ ਹੈ ਅਤੇ ਬਾਕੀ ਮੈਂਬਰ ਝੂਮਰ ਪਾਉਂਦੇ ਹਨ ਗਿੱਧਾ ਆਮ ਤੌਰ 'ਤੇ ਬਜ਼ੁਰਗ ਲੋਕਾਂ ਵੱਲੋਂ ਪਾਇਆ ਜਾਣ ਵਾਲਾ ਪੰਜਾਬੀ ਲੋਕ ਨਾਚ ਜਿਹੜਾ ਕਿ ਸ਼ਾਮਿਲ ਕੀਤਾ ਗਿਆ ਹੈ